ਮੈਨੂੰ ਇਤਿਹਾਸ ਨਾਲ ਜੁੜਨਾ ਅਤੇ ਇਸ ਇਤਿਹਾਸ ਬਾਰੇ ਪੜ੍ਹਨਾ ਬਹੁਤ ਹੀ ਪਸੰਦ ਹੈ ਇਸ ਕਰਕੇ ਮੈਂ ਪੁਰਾਣੇ ਸਟੈਂਪ ਸਿੱਕੇ ਆਦਿ ਚੀਜ਼ਾਂ ਇਕੱਠੀਆਂ ਕਰਦਾ ਰਹਿੰਦਾ ਹਾਂ ਉਹ ਅਤੇ ਸਿੱਕੇ ਮੈਨੂੰ ਪੁਰਾਣੇ ਜ਼ਮਾਨੇ ਬਾਰੇ ਦੱਸਦੇ ਹਨ ਉਸ ਟਾਈਮ ਦੇ ਵਿੱਚ ਕੈਸਾ ਰਾਜ ਸੀ ਅਤੇ ਕਿਹਦਾ ਰਾਜ ਸੀ ਕਿਉਂਕਿ ਸਟੈਂਪਾਂ ਅਤੇ ਸਿੱਕਿਆ ਉੱਤੇ ਜੋ ਇਨਸਾਨ ਉਸ ਸਮੇਂ ਰਾਜ ਕਰ ਰਿਹਾ ਹੁੰਦਾ ਸੀ ਉਸ ਦੀ ਹੀ ਸ਼ਕਲ ਛਾਪੀ ਜਾਂਦੀ ਸੀ ਅਤੇ ਉਹ ਉਸ ਵੇਲੇ ਦੇ ਕਲਾ ਕ੍ਰਿਤ ਕਲਾ ਕ੍ਰਿਤੀਆਂ ਅਤੇ ਸੱਭਿਆਚਾਰ ਬਾਰੇ ਵੀ ਦੱਸਦੇ ਹਨ ਇਸ ਕਰਕੇ ਮੈਨੂੰ ਸਟੈਂਪ ਅਤੇ ਸਿੱਕੇ ਇਕੱਠੇ ਕਰਨਾ ਬਹੁਤ ਪਸੰਦ ਹੈ ਇਹ ਇਕੱਠੇ ਕਰਨ ਤੋਂ ਮੈਨੂੰ ਪੁਰਾਣੇ ਸੱਭਿਆਚਾਰ ਅਤੇ ਇਤਿਹਾਸ ਬਾਰੇ ਹੀ ਪਤਾ ਲੱਗਦਾ ਹੈ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਰਾਜ ਦਾ ਇਤਿਹਾਸ ਕਿੰਨਾ ਹੀ ਰਿਚ ਸੀ ਅਤੇ ਕਿੱਥੇ ਕਿੱਥੇ ਤੱਕ ਫੈਲਿਆ ਹੋਇਆ ਸੀ ਹੁਣ ਮੁਗਲ ਸਮੇਂ ਦੇ ਸਿੱਕੇ ਜਿੱਦਾਂ ਕਿ ਬਹੁਤ ਹੀ ਯੂਨੀਕ ਹਨ ਅਤੇ ਉਹਨਾਂ ਉੱਤੇ ਮੁਗਲਾਂ ਨੇ ਕਾਫ਼ੀ ਅੱਛੀ ਕਲਾਕਾਰੀ ਕੀਤੀ ਹੋਈ ਹੈ ਅੱਜ ਕੱਲ ਦੇ ਸਿੱਕਿਆ ਉੱਤੇ ਗਾਂਧੀ ਜੀ ਦੀ ਸ਼ਕਲ ਛਾਪੀ ਜਾਂਦੀ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਨ ਵਿੱਚ ਇੱਕ ਮੁੱਖ ਪਾਤਰ ਬਣੇ ਸਨ